ਮੈਂ ਤਕਰੀਬਨ ਇੱਕ ਮਹੀਨਾ ਪਹਿਲਾਂ ਆਪਦਾ ਨਵਾਂ ਫ਼ੋਨ ਖਰੀਦਿਆ ਸੀ ਸੈਮਸੰਗ ਐੱਸ ਟਵੈਂਟੀ ਥ੍ਰੀ ਪਰ ਜਿਵੇਂ ਅੱਜ ਕੱਲ੍ਹ ਤਕਨੀਕ ਦਾ ਸਮਾਂ ਵੱਧ ਗਿਆ ਅਤੇ ਤਕਨੀਕ ਹੋਰ ਤੋਂ ਜ ਅੱਗੇ ਤੋਂ ਅੱਗੇ ਅਡਵਾਂਸ ਹੁੰਦੀ ਪਈ ਪਰ ਜੇ ਇੱਕ ਚੀਜ਼ ਦੇਖੀਏ ਤਾਂ ਨਵੇਂ ਫ਼ੋਨਾਂ 'ਚ ਇੱਕ ਚੀਜ਼ ਮਿਸਿੰਗ ਲੱਗਦੀ ਹੈ ਉਹ ਹੈ ਹੈੱਡਫ਼ੋਨ ਜੈਕ ਥ੍ਰੀ ਪੁਆਇੰਟ ਫਾਈਵ ਐੱਮ ਐੱਮ ਜੈਕ ਅਤੇ ਐਸੀ ਲੋੜ ਨੂੰ ਐਸ ਲੋੜ ਦੇ ਵਾਸਤੇ ਕਿਉਂਕਿ ਮੈਂ ਮਿਊਜ਼ਿਕ ਸੁਣਨ ਦਾ ਬੜਾ ਆਦੀ ਇਨਸਾਨ ਹਾਂ ਅਤੇ ਮੈਨੂੰ ਮਿਊਜ਼ਿਕ ਤੋਂ ਬੜਾ ਪਿਆਰ ਆ ਤਾਂ ਕਰਕੇ ਮੈਨੂੰ ਮਿਊਜ਼ਿਕ ਸੁਣਨ ਵਾਸਤੇ ਆਪਣੇ ਹੈੱਡਫ਼ੋਨਸ ਜਾਂ ਈਅਰਫ਼ੋਨਸ ਕੁਛ ਤਾਂ ਚਾਹੀਦਾ ਸੀਗਾ ਤਾਂ ਐਸ ਲਈ ਮੈਂ ਇੱਕ ਬਜਟ ਦੇ ਵਿੱਚ ਅਰਾਉਂਡ ਫਿਫਟੀਨ ਹੰਡਰਡ ਅਤੇ ਪੰਦਰ੍ਹਾਂ ਸੌ ਦੇ ਬਜਟ ਦੇ ਆਲੇ ਦੁਆਲੇ ਮੈਂ ਇੱਕ ਹੈੱਡਫ਼ੋਨ ਖਰੀਦਣਾ ਸੀ ਜਿਹੜਾ ਕਿ ਕੰਫਰਟੇਬਲ ਹੋਵੇ ਜਿਹਦੀ ਬੈਟਰੀ ਲਾਈਫ ਅਠਤਾਲੀ ਘੰਟੇ ਹੋਵੇ ਜਾਂ ਫਿਰ ਲਗਭਗ ਇੱਕ ਦਿਨ ਤੋਂ ਜ਼ਿਆਦਾ ਚੱਲੇ ਅਰਾਉਂਡ ਫੋਰ ਚਾਲ੍ਹੀ ਘੰਟੇ ਹੋਵੇ ਜਾਂ ਐਸ ਤੋਂ ਤਕਰੀਬਨ ਐਸ ਦੇ ਕਰੀਬ ਹੋਵੇ ਅਤੇ ਮੈਂ ਇੱਕ ਵਧੀਆ ਸਟਾਈਲਿਸ਼ ਲੁਕਿੰਗ ਅਤੇ ਐੱਲ ਈ ਡੀ ਦੇ ਨਾਲ ਇੱਕ ਹੈੱਡਫ਼ੋਨਸ ਭਾਲਦਾ ਸੀ ਤਾਂ ਫੇਰ ਓਥੇ ਸਰਚ ਕਰਦਿਆਂ ਕਰਦਿਆਂ ਮਾਰਕੀਟ ਸਰਚ ਕਰਦਿਆਂ ਹੋਇਆ ਮੈਨੂੰ ਜਾਬਰੋਨਿਕਸ ਦਾ ਜ਼ੈੱਬ ਡੀਊਕ ਮੋਡਲ ਮਿਲਿਆ ਜਿਹੜਾ ਹੈੱਡਫ਼ੋਨਸ ਬਾਰ੍ਹਾਂ ਸੌ ਉਸ ਵਕਤ ਥੋੜ੍ਹੇ ਕਿਸੇ ਛੂਟ ਦੇ ਨਾਲ ਕਿਸੇ ਛੂਟ ਦੇ ਨਾਲ ਅਤੇ ਐਕਸਿਸ ਬੈਂਕ ਦੇ ਅਕਾਊਂਟ ਦੇ ਨਾਲ ਮੈਨੂੰ ਪੱਚੀ ਪਰਸੈਂਟ ਡਿਸਕਾਊਂਟ 'ਤੇ ਲਗਭਗ ਬਾਰਾਂ ਸੌ ਰੁਪਏ ਦਾ ਮਿਲ ਗਿਆ ਸੀ ਅਤੇ ਮੈਂ ਜਦੋਂ ਉਹਨੂੰ ਲਿਆ ਕੇ ਵਰਤਣਾ ਸ਼ੁਰੂ ਕੀਤਾ ਅਤੇ ਉਹਦੇ ਜਿਹੜੇ ਕੋਸ਼ਨ ਸੀਗੇ ਜਿਹੜੇ ਏਅਰ ਕਸ਼ਨ ਸੀਗੇ ਉਹ ਬੜੇ ਕੰਫਰਟੇਬਲ ਸੀਗੇ ਉਹਦੇ ਡ੍ਰਾਈਵਰਸ ਵੱਡੇ ਸੀਗੇ ਅਤੇ ਨੋਆਇਸ ਕੈਂਸਲੇਸ਼ਨ ਬਹੁਤ ਚੰਗਾ ਸੀ ਮਿਊਜ਼ਿਕ ਦਾ ਜਿਹੜਾ ਮੇਰਾ ਐਕਸਪੀਰੀਐਂਸ ਰਿਹਾ ਜੇਬਰੋਨਿਕਸ ਦੇ ਹੈੱਡਫ਼ੋਨ ਲੈਣ ਮਗਰੋਂ ਤਾਂ ਬਹੁਤ ਹੀ ਉਮਦਾ ਕਿਸਮ ਦਾ ਐਕਸਪੀਰੀਐਂਸ ਰਿਹਾ ਕਿਉਂਕਿ ਉਨ੍ਹਾਂ ਵਿੱਚੋਂ ਕੋਈ ਵੋਇਸ ਲੀਕ ਨਹੀਂ ਹੁੰਦੀ ਜਾਂ ਨੋਇਸ ਬ੍ਰੇਕ ਨਹੀਂ ਹੁੰਦੀ ਨੋਇਸ ਕੈਂਸਲੇਸ਼ਨ ਬਹੁਤ ਵਧੀਆ ਹੈ ਕੰਫਰਟੇਬਲ ਹੈ ਅਤੇ ਲਏ ਮਗਰੋਂ ਮੈਂ ਉਹਨੂੰ ਸ਼ਾਇਦ ਇੱਕ ਵਾਰ ਹੀ ਚਾਰਜ ਕੀਤਾ ਦੋ ਮਹੀਨੇ 'ਚ ਅਤੇ ਮੇਰਾ ਯੂਜਸ ਵੀ ਕਾਫ਼ੀ ਹੈਵੀ ਹੈ ਫੇਰ ਵੀ ਉਹ ਬੜਾ ਕਾਫ਼ੀ ਸਟਾਈਲਿਸ਼ ਹੈ ਦਿਖਣ 'ਚ ਬਲੈਕ ਕਲਰ ਅਤੇ ਮੈਟਲ ਬੈਲਟ ਸੈਮ ਮੈਟਲ ਅਤੇ ਉਹਦਾ ਜਿਹੜਾ ਪਲਾਸਟਿਕ ਦੀ ਕੁਆਲਟੀ ਉਹ ਵੀ ਕਾਫ਼ੀ ਅੱਛੀ ਹੈ ਅਤੇ ਕੁਸ਼ਨਸ ਵੀ ਬਹੁਤ ਹੀ ਵਧੀਆ ਕੁਆਲਟੀ ਦੇ ਹੈ ਕੰਫਰਟੇਬਲ ਕੰਫਿਊਨ ਏਅਰਸ ਅਤੇ ਚਾਰਜਿੰਗ ਸੀ ਟਾਇਪ ਚਾਰਜਿੰਗ ਹੈ ਯੂਨੀਵਰਸਲ ਤਾਂ ਮੈਂ ਉਸਨੂੰ ਕਿਸੇ ਵੀ ਇੱਕ ਡਿਵਾਇਸ ਨਾਲ ਜਿਹੜੇ ਇੱਕ ਹੀ ਡਿਵਾਇਸ ਦੇ ਚਾਰਜਰ ਨਾਲ ਮੈਂ ਆਪਣੇ ਸਾਰੇ ਡਿਵਾਈਸ ਚਾਰਜ ਕਰ ਸਕਦਾ